ਹਾਂ ਮੇਰੀ ਮਾਂ ਨੇ ਮੇਰਾ ਖਾਣਾ ਬਣਾਉਣ ਦੇ ਸ਼ੌਕ ਨੂੰ ਉਜਾਗਰ ਕੀਤਾ ਅਤੇ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਅਤੇ ਮੈਂ ਖਾਣਾ ਬਣਾਉਣ ਦਾ ਮੈਨੂੰ ਬਹੁਤ ਸ਼ੌਂਕ ਸੀ ਅਤੇ ਮੈਂ ਮਾਂ ਦੇ ਨਾਲ ਰਸੋਈ ਵਿੱਚ ਉਹਨਾਂ ਨੂੰ ਕੰਮ ਕਰਦੇ ਦੇਖਦੀ ਹੁੰਦੀ ਸੀ ਅਤੇ ਉਹਨਾਂ ਨੂੰ ਖਾਣਾ ਬਣਾਉਂਦਿਆਂ ਦੇਖਦੀ ਖਲੋਤੀ ਕਿੰਨਾ ਚਿਰ ਵੇਖਦੀ ਰਹਿੰਦੀ ਹੁੰਦੀ ਸੀ ਅਤੇ ਉਹ ਮਾਂ ਪਿਤਾ ਜੀ ਨੂੰ ਕਹਿੰਦੇ ਹੁੰਦੇ ਸੀ ਇਹ ਫੜਾ ਦਿਓ ਉਹ ਫੜਾ ਦਿਓ ਅਤੇ ਫਿਰ ਮੈਂ ਜਦੋਂ ਜਦੋਂ ਹੌਲੀ ਹੌਲੀ ਵੱਡੇ ਹੋਈ ਤਾਂ ਫਿਰ ਮੈਂ ਆਟੇ ਦੀਆਂ ਲੋਈਆਂ ਬਣਾ ਕੇ ਮਾਂ ਨੂੰ ਦੇਣ ਲੱਗੀ ਅਤੇ ਮਾਂ ਰੋਟੀ ਵੇਲਣ ਲੱਗ ਜਾਂਦੀ ਸੀ ਫਿਰ ਮੈਂ ਜਦੋਂ ਹੋਰ ਵੱਡੀ ਹੋਈ ਤਾਂ ਮੈਂ ਰੋਟੀਆਂ ਵੇਲਣੀਆਂ ਸ਼ੁਰੂ ਕੀਤੀਆਂ ਪਰ ਸ਼ੁਰੂ ਸ਼ੁਰੂ ਵਿੱਚ ਮੇਰੀ ਰੋਟੀ ਗੋਲ ਨਹੀਂ ਬਣਦੀ ਸੀ ਕੋਈ ਬਣਦੀ ਗੋ ਹਵਾਈ ਜਹਾਜ਼ ਬਣ ਜਾਂਦਾ ਸੀ ਕੋਈ ਵਿੰਗੀ ਚਿੱਪੀ ਬਣ ਜਾਂਦੀ ਸੀ ਅਤੇ ਜਦੋਂ ਮੈਂ ਰੋਟੀ ਸੇਕਦੀ ਹੁੰਦੀ ਸੀ ਉਹ ਵੀ ਸੜ ਜਾਂਦੀ ਹੁੰਦੀ ਸੀ ਪਰ ਮੇਰੇ ਪਿਤਾ ਜੀ ਫਿਰ ਵੀ ਬੜੇ ਖੁਸ਼ ਹੋ ਕੇ ਖਾਂਦੇ ਸੀ ਅਤੇ ਬੜੀ ਰੀਜ ਨਾਲ ਖਾਂਦੇ ਸੀ ਫਿਰ ਮੈਂ ਹੌਲੀ ਹੌਲੀ ਰੋਟੀਆਂ ਬਣਾਉਣੀਆਂ ਵੀ ਸਿੱਖ ਗਈ ਅਤੇ ਸਬਜੀ ਬਣਾਉਣੀ ਵੀ ਸਿੱਖ ਗਈ ਅਤੇ ਘਰ ਦਾ ਹਰ ਮੈਂਬਰ ਉਸਨੂੰ ਬੜੇ ਰੀਝ ਨਾਲ ਖਾਂਦਾ ਸੀ ਧੰਨਵਾਦ